ਅੱਜ ਦੇ ਸਮੇਂ ਵਿੱਚ ਭਾਰਤ ਬਹੁਤ ਸਾਰੀਆਂ ਮੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜਿਹਨਾਂ ਵਿੱਚੋਂ ਮ ਮੁੱਖ ਹੈਗੀਆਂ ਨੇ ਜਿਵੇਂ ਬੇਰੁਜ਼ਗਾਰੀ ਬੇਰੁਜ਼ਗਾਰੀ ਅੱਜ ਕੱਲ੍ਹ ਦੀ ਪੀੜ੍ਹੀ ਵਿੱਚ ਆਪਾਂ ਦੇਖ ਰਹੇ ਹਾਂ ਕਿ ਇਹ ਮਾਨ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੀ ਹੈ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋਏ ਬੱਚੇ ਜਿੱਦਾਂ ਪੋਸਟ ਗ੍ਰੈਜੂਏਟ ਈਵਨ ਗਰੈਜੂਏਟ ਉਹ ਸਾਰੇ ਲੋਕ ਕੀ ਨੇ ਹਜੇ ਤੱਕ ਮਤਲਬ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਆਪਣੇ ਕੰਪੀਟੀਸ਼ਨ ਬਹੁਤ ਵੱਧ ਰਿਹਾ ਤਾਂ ਕਰਕੇ ਬੇਰੁਜ਼ਗਾਰੀ ਦਾ ਬੱਚੇ ਬੜਾ ਉਹ ਕਰ ਰਹੇ ਆ ਅਤੇ ਵੱਧਦੀ ਬੇਰੁਜ਼ਗਾਰੀ ਨਾਲ ਕੀ ਹੋ ਰਿਹਾ ਜਿਹੜੇ ਬਹੁਤ ਹੀ ਲਾਇਕ ਆਪਣੇ ਬੱਚੇ ਹੈਗੇ ਆ ਉਹਨਾਂ ਨੂੰ ਇੱਕ ਚੰਗੀਆਂ ਨੌਕਰੀਆਂ ਦੀ ਜਿਹੜੀ ਉਹ ਰੱਖ ਰਹੇ ਸੀਗੇ ਇੱਛਾ ਉਹ ਨਹੀਂ ਮਿਲ ਪਾ ਰਹੀ ਇੰਨਾਂ ਇੰਨੀਆਂ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਵੀ ਤਾਂ ਕਰਕੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਰੁਝਾਨ ਆ ਉਹ ਸੁਸਾਈਡ ਜਿਹੜੇ ਆਪਣੇ ਸੁਸਾਈਡ ਆਤਮ ਹੱਤਿਆਵਾਂ ਆਤਮ ਹੱਤਿਆ ਵਗੈਰਾ ਉਹਨਾਂ ਵੱਲ ਰੁਝਾਨ ਉਹਨਾਂ ਦਾ ਬੜਾ ਵੱਧ ਰਿਹਾ ਅਤੇ ਇੱਕ ਜਿਹੜੀ ਦੂਜੀ ਚੁਣੌਤੀ ਹੈਗੀ ਆ ਉਹ ਹੈਗਾ ਮੇਨ ਆਪਣੇ ਮੁੱਖ ਨਸ਼ਾ ਡਰੱਗਸ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਇੱਕ ਤਾਂ ਮਤਲਬ ਬ ਆਪਾਂ ਕਹਿ ਸਕਦੇ ਹਾਂ ਵੀ ਇੱਕ ਮ ਮਤਲਬ ਆਉਣ ਵਾਲੇ ਸੁਵਿਧਾਵਾਂ ਦੇ ਨਾਲ ਨਸ਼ਾ ਦਾ ਜਿਹੜਾ ਆਪਾਂ ਕਹਿ ਰਹੇ ਹਾਂ ਨਾ ਇੱਕ ਵੀ ਚਲਣ ਵੱਧ ਚੁੱਕਿਆ ਗਾ ਅਤੇ ਨਸ਼ੇ ਕਰਕੇ ਆਪਣੇ ਜਿਹੜੀ ਆਉਣ ਵਾਲੀ ਮਤਲਬ ਪੀੜ੍ਹੀ ਆ ਤਾਂ ਜਿਹੜੀ ਹੁਣ ਹੋਣ ਵਾਲੀ ਨੌ ਨੌਜਵਾਨ ਨੇ ਮਤਲਬ ਬੜਾ ਇਹ ਫੇਸ ਕਰ ਰਹੇ ਨੇ ਨਸ਼ੇ ਦਾ ਨਸ਼ੇ ਕਰਕੇ ਕੀ ਹੈ ਵੀ ਬਹੁਤ ਸਾਰੇ ਮਤਲਬ ਆਪਾਂ ਡੇਲੀ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਜਾਨਾਂ ਜਾ ਰਹੀਆਂ ਨੇ ਤਾਂ ਨਸ਼ੇ ਦੇ ਵਿੱਚ ਵੀ ਅੱਜ ਕੱਲ੍ਹ ਬੜੇ ਮਤਲਬ ਮੈਡੀਕਲ ਨਸ਼ੇ ਚੱਲ ਚੱਲ ਚੁੱਕੇ ਆ ਜਿਹਨਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਬ ਮਤਲਬ ਬੱਚਾ ਛੱਡ ਹੀ ਨਹੀਂ ਪਾ ਰਿਹਾ ਹੈਗਾ ਤਾਂ ਇੱਕ ਨਸ਼ੇ ਵੀ ਜਿਹੜੇ ਹੈਗੇ ਨੇ ਵੀ ਇੱਕ ਵੱਡੀ ਆਪਾਂ ਨੂੰ ਵੱਡੀ ਚੁਣੌਤੀ ਹੈਗੀ ਹੈ ਅਗਲਾ ਆਪਾਂ ਮੇਨ ਆਪਾਂ ਚੁਣੌਤੀ ਜੀ ਦੀ ਜੇ ਗੱਲ ਕਰੀਏ ਉਹ ਹੈਗਾ ਆਪਣਾ ਆਪਣੀਆਂ ਜਿਵੇਂ ਸਿਖ ਆਪਣਾ ਸਿਹਤ ਸੁਵਿਧਾਵਾਂ ਸਿਹਤ ਸੁਵਿਧਾਵਾਂ ਦੇ ਵਿੱਚ ਆਪਾਂ ਦੇਖਦੇ ਹਾਂ ਹੁਣ ਸਰਕਾਰੀ ਹਸਪਤਾਲ ਨੇ ਸਰਕਾਰੀ ਹਸਪਤਾਲਾਂ ਦਾ ਬੜਾ ਹੀ ਬੁਰਾ ਹਾਲ ਹੈ ਅਤੇ ਹੁਣ ਕਈ ਪ੍ਰਾਈਵੇਟ ਹਸਪਤਾਲ ਨੇ ਜਿੱਥੇ ਆਪਾਂ ਕਹਿ ਦਿੰਦੇ ਹਾਂ ਵੀ ਬਹੁਤ ਵਧੀਆ ਉਹਨਾਂ ਦਾ ਹੈਗਾ ਜਿਹੜਾ ਵੀ ਬਾਹਰੀ ਦਿੱਖ ਤੋਂ ਆਪਾਂ ਨੂੰ ਲੱਗਦਾ ਵੀ ਬਹੁਤ ਵਧੀਆ ਨੇ ਹਸਪਤਾਲ ਪਰ ਹੁਣ ਜਿਹੜਾ ਇੱਕ ਕੋਈ ਗਰੀਬ ਹੈ ਉਹ ਹੈਗਾ ਉਹ ਮਤਲਬ ਉੱਥੋਂ ਪ੍ਰਾਈਵੇਟ ਹਸਪਤਾਲ ਉੱਥੋਂ ਦਾ ਖਰਚਾ ਉਹ ਚੱਕ ਹੀ ਨਹੀਂ ਪਾ ਰਿਹਾ ਤਾਂ ਇੱਥੇ ਜਿਹੜੀ ਫਿਰ ਮੇਨ ਦਿੱਕਤ ਆ ਰਹੀ ਹੈ ਉਹ ਹੈਗੀ ਹੈ ਜਿਹੜੀ ਵੀ ਆਪਣਾ ਜਿਹੜਾ ਨਿਚਲਾ ਵਰਗ ਹੈ ਮਤਲਬ ਜਿਹਨਾਂ ਦੀ ਥੋੜ੍ਹੀ ਜਿਹੀ ਆਪਾਂ ਕਹਿ ਲਈਏ ਆਮਦਨ ਘੱਟ ਹੈ ਤਾਂ ਉਹ ਲੋਕ ਕੀ ਆ ਅਪ ਇੰਨਾਂ ਜ਼ਿਆਦਾ ਇਲਾਜ ਨਹੀਂ ਚੱਕ ਪਾ ਰਹੇ ਤਾਂ ਇਹ ਇੱਕ ਮਤਲਬ ਇ ਇਸ ਦੇ ਵਿੱਚ ਵੀ ਆਪਾਂ ਨੂੰ ਸੁਧਾਰ ਲਿਆਉਣ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਦੂਜੀ ਚੁਣੌਤੀ ਦੀ ਆਪਾਂ ਜੇ ਗੱਲ ਕਰੀਏ ਵਧਦੀ ਜਨਸੰਖਿਆ ਹੋ ਗਈ ਉਸ ਤੋਂ ਇਲਾਵਾ ਜਿੱਦਾਂ ਆਪਣਾ ਅੱਜ ਕੱਲ੍ਹ ਦੇਖੀਏ ਆਪਾਂ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਰਿਹਾ ਹੁਣ ਆਪਾਂ ਇੰਨੀ ਦਿਨੀ ਜੇ ਗੱਲ ਕਰੀਏ ਆਪਾਂ ਆਪਣੇ ਆਪਾਂ ਨੇੜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਬੜਾ ਬੁਰਾ ਹਾਲ ਹੋ ਰਿਹਾ ਮੌਸਮ ਦਾ ਆਪਾਂ ਦੇਖੀਏ ਵੀ ਹਲੇ ਤੱਕ ਮੌਨਸੂਨ ਇੱਥੇ ਆਈ ਨਹੀਂ ਹੈਗੀ ਤਾਂ ਜਿਹੜਾ ਮੌਸਮ ਦੇ ਵਿੱਚ ਬਦਲਾਓ ਆ ਨਾ ਉਹ ਮਤਲਬ ਵੀ ਪਿਛਲੇ ਕੁਛ ਸਾਲਾਂ ਦੇ ਜੇ ਆਪਾਂ ਕੰ ਆਪਾਂ ਉਹ ਕਰਕੇ ਤੁਲਨਾ ਕਰਕੇ ਦੇਖੀਏ ਤਾਂ ਜ਼ਿਆਦਾ ਖਰਾਬ ਹੋ ਰਿਹਾ ਅਗਲੀ ਆਪਾਂ ਜੇ ਚੁਣੌਤੀ ਦੀ ਗੱਲ ਕਰੀਏ ਤਾਂ ਆਪਣਾ ਜਿਹੜੀ ਸਿੱਖਿਆ ਨੀਤੀ ਹੈ ਸਿੱਖਿਆ ਨੀਤੀ ਦੇ ਵਿੱਚ ਵੀ ਆਪਾਂ ਨੂੰ ਬੜਾ ਸੁਧਾਰ ਲਿਆਉਣ ਦੀ ਲੋੜ ਹੈ ਹਾਲਾਂਕਿ ਕਿ ਆਪ ਆਪਣੇ ਪਿੱਛੇ ਜੇ ਆਪਾਂ ਖਬਰਾਂ ਪੜ੍ਹੀਆਂ ਨੇ ਵੀ ਨਵੀਂ ਸਿੱਖਿਆ ਪ੍ਰਣਾਲੀ ਕਹਿ ਰਹੇ ਨੇ ਵੀ ਲਾਗੂ ਕੀਤੀ ਹੈ ਪਰ ਫਿਰ ਵੀ ਮਤਲਬ ਕਿਤੇ ਨਾ ਕਿਤੇ ਵੀ ਇਸ ਜਿਹੜੀ ਸਿੱਖਿਆ ਨੀਤੀ ਹੈ ਇਹਦੇ ਵਿੱਚ ਬਹੁਤ ਸਾਰਾ ਸੁਧਾਰ ਲਿਆਉਣ ਦੀ ਆਪਾਂ ਨੂੰ ਲੋੜ ਹੈਗੀ ਹੈ